ਹੈਲੋ ਹਾਂਜੀ ਕੌਣ ਹਾਂਜੀ ਮੈਂ ਉੱਥੋਂ ਹੀ ਬੋਲ ਰਹੀ ਹਾਂ ਮੈਂ ਤੁਹਾਨੂੰ ਪਰ ਪਛਾਣਿਆ ਨਹੀਂ ਹਾਂਜੀ ਹਾਂਜੀ ਕੀ ਹੋਇਆ ਇੱਦਾਂ ਤਾਂ ਨਹੀਂ ਹੋ ਸਕਦਾ ਕਿਉਂਕਿ ਮੈਨੂੰ ਯਾਦ ਹੈ ਕਿ ਮੈਂ ਤੁਹਾਡਾ ਨਾਪ ਸਹੀ ਲਿਆ ਸੀਗਾ ਪਰ ਮੈਂ ਤੁਸੀਂ ਮੈਨੂੰ ਦੱਸੋ ਨਾ ਕਿੱਥੋਂ ਤੁਹਾਡੀ ਸ਼ਰਟ ਟਾਈਟ ਹੈ ਤੁਹਾਡੇ ਬਾਹਾਂ ਤੋਂ ਅਤੇ ਹੋਰ ਕੋਈ ਪ੍ਰੋਬਲਮ ਇੱਦਾਂ ਤਾਂ ਨਹੀਂ ਹੋ ਸਕਦਾ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਮੇਰੇ ਤੋਂ ਹੀ ਸੁਆਉਂਦੇ ਹੋ ਪਹਿਲਾਂ ਤਾਂ ਤੁਹਾਡੀ ਕੋਈ ਕੰਪਲੇਂਟ ਨਹੀਂ ਆਈ ਤੁਹਾਡੀ ਪਹਿਲੀ ਹੋ ਮੈਨੂੰ ਲੱਗਦਾ ਕੰਪਲੇਟ ਹੈ ਚਲੋ ਕੋਈ ਨਾ ਤੁਸੀਂ ਇੱਕ ਕੰਮ ਕਰਨਾ ਮੈਂ ਅੱਜ ਤਾਂ ਬਿਜ਼ੀ ਹਾਂ ਤੁਸੀਂ ਕੱਲ੍ਹ ਮੇਰੀ ਸ਼ੋਪ 'ਤੇ ਆ ਜਾਣਾ ਸ਼ਰਟ ਲੈ ਕੇ ਓ ਤੇ ਉਹੋ ਮੈਂ ਚਲੋ ਕੋਈ ਨਹੀਂ ਮੈਂ ਦੱਸ ਦਾਂਗੀ ਤੁਹਾਨੂੰ ਵੀ ਕੀ ਹੋਏਗਾ ਮੈਂ ਐਕਚੁਲੀ ਕਿਤੇ ਬੀਜੀ ਸੀਗੀ ਅੱਜ ਚਲੋ ਕੋਈ ਨਹੀਂ ਪਰ ਫਿਰ ਮੈਂ ਤੁਹਾਡੇ ਲਈ ਥੋੜ੍ਹਾ ਜਿਹਾ ਟਾਈਮ ਕੱਢ ਦੂੰਗੀ ਤੁਸੀਂ ਆ ਜਾਇਓ ਤੁਸੀਂ ਰਾਤ ਸ਼ਾਮ ਛੇ ਵਜੇ ਆ ਜਾਇਓ ਮੈਂ ਤੁਹਾਨੂੰ ਦੇਖ ਲਵਾਂਗੀ ਨਾਲੇ ਤੁਹਾਨੂੰ ਉੱਥੇ ਹੀ ਫੀਟਿੰਗ ਕਰ ਦੇਵਾਂਗੀ ਅਤੇ ਉੱਥੇ ਹੀ ਤੁਹਾਨੂੰ ਪਵਾ ਕੇ ਦੇਖਾਂਗੀ ਨਹੀਂ ਨਹੀਂ ਕਿਉਂਕਿ ਉਹ ਤਾਂ ਤੁਸੀਂ ਪਹਿਲਾਂ ਹੀ ਪੇਮੈਂਟ ਕਰ ਚੁੱਕੇ ਹੋ ਨਾ ਅਤੇ ਫਿਰ ਇਹ ਮੇਰ ਮੇਰੀ ਓ ਗਲਤੀ ਸੀ ਵੀ ਸੋਰੀ ਵੀ ਮੈਂ ਤੁਹਾਨੂੰ ਗਲਤ ਕਰਤਾ ਹਾਂਜੀ ਤੁਸੀਂ ਛੇ ਵਜੇ ਆ ਜਾਇਓ